ਜੇਕਰ ਸਾਡੇ ਖੇਡਦੇ ਸਮੇਂ ਸਾਡੀ ਰਾਜ ਵਾਲੀ ਸਾਈਡ ਜੇ ਕੋਈ ਜ਼ਖਮੀ ਹੋ ਜਾਂਦਾ ਹੈ ਪਲੇਅਰ ਉਸ ਨੂੰ ਪਹਿਲਾਂ ਤਾਂ ਮੈਡੀਕਲ ਜਿਹੜੀ ਕਮੇਟੀ ਬਣੀ ਹੁੰਦੀ ਹੈ ਉਹਦੇ ਵੱਲੋਂ ਫੈਸਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਅਤੇ ਉੱਥੇ ਨਾ ਕਿ ਕੇਵਲ ਐਵੇਂ ਝੋਲਾ ਛਾਪ ਡਾਕਟਰ ਨਹੀਂ ਅਸੀਂ ਰੱਖਦੇ ਅਸੀਂ ਡਾਕਟਰ ਵੀ ਪੂਰੇ ਪੜ੍ਹੇ ਲਿਖੇ ਅਤੇ ਗਰੈਜੂਏਟ ਡੋਕਟਰ ਰੱਖਦੇ ਆ ਜਿਹਨਾਂ ਨੂੰ ਕੋਈ ਨੌਲੇਜ ਹੈ ਅਤੇ ਸਰਕਾਰੀ ਡਾਕਟਰ ਹੁੰਦੇ ਨੇ ਉਹ ਸਭ ਦਾ ਇਲਾਜ ਕਰਦੇ ਨੇ ਅਤੇ ਉਹਨਾਂ ਦਾ ਧਿਆਨ ਰੱਖਦੇ ਨੇ ਜੇ ਕੋਈ ਪਲੇਅਰ ਜ਼ਖਮੀ ਹੋ ਗਿਆ ਜਾਂ ਕਿਸੇ ਦੇ ਫੈਕਚਰ ਆ ਗਿਆ ਉਹ ਨਾਲੋਂ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਰੈਸਟ ਦਿੰਦੇ ਹਨ ਅਤੇ ਉਸ ਦੀ ਥਾਂ 'ਤੇ ਪਲੇਅਰ ਨੂੰ ਚੇਂਜ ਕੀਤਾ ਜਾਂਦਾ ਹੈ ਅਤੇ ਇਹ ਸਾਰੀਆਂ ਫੈਸਿਲਿਟੀਆਂ ਕਮੇਟੀ ਡਿਸਾਈਡ ਕਰਦੀਆਂ ਹਨ ਕਿਉਂਕਿ ਕਮੇਟੀਆਂ ਅਲੱਗ ਅਲੱਗ ਹੁੰਦੀਆਂ ਹਨ ਮੈਡੀਕਲ ਦੀ ਇੱਕ ਆਪਣੀ ਕਮੇਟੀ ਹੈ ਇਸ ਦੀ ਆਪਣੀ ਇੱਕ ਉਹ ਆਪਣਾ ਖੇਤਰ ਹੈ ਕਮੇਟੀ ਮੈਡੀਕਲ ਕਮੇਟੀ ਦਾ ਕਿਉਂਕਿ ਇਹਦੇ ਵਿੱਚ ਡੋਕਟਰ ਵੀ ਹੁੰਦੇ ਹਨ ਲੇਡੀਜ਼ ਡੋਕਟਰ ਵੀ ਨੇ ਕਿਉਂਕਿ ਕਈ ਵਾਰੀ ਲੇਡੀਜ਼ ਪਲੇਅਰ ਹੁੰਦੇ ਨੇ ਉਹ ਲੇਡੀਜ਼ ਡੋਕਟਰ ਨਾਲ ਜ਼ਿਆਦਾ ਕੰਫਰਟੇਬਲ ਫੀਲ ਕਰਦੇ ਨੇ ਅਤੇ ਉਹਨਾਂ ਨੂੰ ਲੇਡੀਜ਼ ਡੋਕਟਰ ਪ੍ਰੋਵਾਈਡ ਕਰਵਾਏ ਜਾਂਦੇ ਹਨ ਜੈਂਟਸ ਡੋਕਟਰ ਤਾਂ ਜ਼ਿਆਦਾ ਉਹਨਾਂ ਦਾ ਮੇਲ ਪਲੇਅਰ ਦੇ ਨਾਲ ਰਹਿੰਦੇ ਹਨ ਤੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਵਾਉਂਦੇ